ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਤ ਬੋਲਦੀ ਹਾਂ ਫਰੀਦਕੋਟ ਤੋਂ ਮੈਂ ਯਾਨੀ ਕਿ ਆਪਣੇ ਯਾਨੀ ਕਿ ਤੁਸੀਂ ਪ੍ਰਬੰਧਕ ਕਮੇਟੀ ਵੱਲੋਂ ਗੱਲ ਕਰ ਰਹੇ ਹੋ ਮੇਰੇ ਨਾਲ ਮੈਂ ਤੁਹਾਨੂੰ ਨਾ ਆਪਣੇ ਯਾਨੀ ਕਿ ਮੁਹੱਲੇ ਦੇ ਜਿਹੜੇ ਸਾਫ਼ ਸਫਾਈ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਸ਼ੇਅਰ ਗੱਲ ਕਰਨੀ ਸੀ ਕਿਉਂਕਿ ਮੈਨੂੰ ਨਾ ਵੈਸੇ ਜ਼ਿਆਦਾਤਰ ਪਸੰਦ ਹੈ ਸਫਾਈ ਨਾ ਮੈਂ ਆਪਣੇ ਬੂਹੇ 'ਚ ਗੰਦ ਚੰਗਾ ਨਹੀਂ ਸਮਝਦੀ ਮੁਹੱਲੇ 'ਚ ਪਸੰਦ ਕਰਨਾ ਬਿਲਕੁਲ ਨਹੀਂ ਮੈਨੂੰ ਪਸੰਦ ਇਸ ਕਰਕੇ ਯਾਨੀ ਕਿ ਅਸੀਂ ਮੁਹੱਲੇ ਵਾਲਿਆਂ ਨੇ ਸੋਚਿਆ ਹੋਇਆ ਕਿ ਜਿਹੜਾ ਆਪਣਾ ਯਾਨੀ ਕਿ ਆਪਾਂ ਆਪਣੇ ਬੂਹੇ ਸਾਫ਼ ਕਰਦੇ ਹਾਂ ਜੋ ਵੀ ਆਪਾਂ ਕੂੜਾ ਇਕੱਠਾ ਕਰਦੇ ਹਾਂ ਉਹਨੂੰ ਆਪਾਂ ਕਿੱਦਾਂ ਲਪੇਟਣਾ ਕਿੱਦਾਂ ਕਿਹੜੀ ਚੀਜ਼ ਦੇ ਵਿੱਚ ਆਪਾਂ ਰੱਖਣਾ ਹੁਣ ਉਹਨਾਂ ਨੂੰ ਮੈਂ ਯਾਨੀ ਕਿ ਮੈਂ ਤੁਹਾਡੇ ਅੱਗੇ ਇਹ ਹੀ ਤੁਹਾਡੇ ਅੱਗੇ ਆਪਣਾ ਪ੍ਰਸ਼ਨ ਰੱਖਦੀ ਹਾਂ ਕੀ ਤੁਸੀਂ ਮੈਨੂੰ ਇੱਕ ਮੇਰੀ ਹੈਲਪ ਕਰੋ ਕਿ ਮੈਂ ਜਿਹੜਾ ਉਹ ਮੁਹੱਲੇ ਦਾ ਸੀ ਅਸੀਂ ਕੂੜਾ ਸ਼ੁਰੂ ਕੀਤਾ ਹੋਇਆ ਇਕੱਠਾ ਕਰਕੇ ਕਿ ਆਪਣੀ ਮੁਹੱਲੇ ਦੀ ਸਫਾਈ ਕਰਨੀ ਸ਼ੁਰੂ ਕੀਤੀ ਹੋਈ ਹੈ ਕਿ ਉਹ ਚੰਗੀ ਤਰ੍ਹਾਂ ਸਾਫ਼ ਰਹੇ ਅਤੇ ਜਿਹੜਾ ਕੂੜਾ ਇਕੱਠਾ ਹੁੰਦਾ ਉਹ ਖਿਲਰੇ ਨਾ ਦੁਬਾਰਾ ਯਾਨੀ ਕਿ ਉਹ ਆਪਣਾ ਟਾਈਮ ਟੂ ਟਾਈਮ ਯਾਨੀ ਕਿ ਇਹ ਯਾਨੀ ਕਿ ਇਕੱਠਾ ਹੋ ਕੇ ਤੁਸੀਂ ਉਹਦਾ ਪ੍ਰਬੰਧ ਕਰੋ ਮੈਂ ਕੋਈ ਮੁਲਾਜ਼ਮ ਸਾਨੂੰ ਦਿਓ ਜਿਹੜਾ ਯਾਨੀ ਕਿ ਸਵੇਰੇ ਆਵੇ ਅਤੇ ਸਫਾਈ ਵਾਲਾ ਜਿਹੜਾ ਉਹ ਸਾਡਾ ਕੂੜਾ ਉਹ ਚੁੱਕ ਕੇ ਯਾਨੀ ਕਿ ਆਪਣੇ ਚੰਗੀ ਯਾਨੀ ਕਿ ਜਗ੍ਹਾ 'ਤੇ ਸੁੱਟੇ ਕਿ ਜਿੱਥੇ ਕੋਈ ਉਸ ਕੂੜੇ ਦੀ ਸਮੈਲ ਨਾ ਕੋਈ ਪ੍ਰੋਬਲਮ ਵੀ ਨਾ ਆਵੇ ਕਿਸੇ ਨੂੰ ਯਾਨੀ ਕਿ ਬਿਮਾਰੀ ਵੀ ਨਾ ਲੱਗੇ ਕੋਈ ਮ ਬੱਚੇ ਖੇਡਦੇ ਆ ਲਾਗੇ ਸ਼ਾਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਯਾਨੀ ਕਿ ਅਸੀਂ ਤੁਹਾਡੇ ਤੋਂ ਇੱਕ ਸਹਾਇਤਾ ਮੰਗਦੇ ਹਾਂ ਅਤੇ ਉਹ ਤੁਸੀਂ ਮੈਨੂੰ ਜ਼ਰੂਰ ਦਿਓ ਮੇਰੀ ਹੈਲਪ ਕਰੋ ਸਤਿ ਸ਼੍ਰੀ ਅਕਾਲ ਜੀ